ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਕੌਣ ਹਾਂਜੀ ਬਿਲਕੁਲ ਮਨਵੀਰ ਬੋਲ ਰਹੀ ਮੈਂ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਕਿਹੜੀ ਕਿਹੜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹਾਂਜੀ ਹਾਂਜੀ ਹਾਂਜੀ ਮੇਨ ਮੈਮ ਮੇਨ ਇਹਦਾ ਕੰਮ ਬਣਾਉਣ ਲਈ ਹੁੰਦਾ ਕਿ ਗਰਲਸ ਦੀ ਲਾਈਫ ਨੂੰ ਸਿਕਿਓਰ ਕੀਤਾ ਜਾਵੇ ਜੋ ਜੋ ਗਰਲਸ ਨੂੰ ਪ੍ਰੋਬਲਮ ਆ ਰਹੀ ਉਹਨਾਂ ਤੋਂ ਉਹਨਾਂ ਨੂੰ ਥੋੜ੍ਹਾ ਜਿਹਾ ਪ੍ਰੋਟੈਕਟ ਕੀਤਾ ਜਾ ਸਕੇ ਹਾਂਜੀ

ਹਾਂਜੀ ਹਾਂਜੀ ਹਾਜੀ ਹਾਂਜੀ ਹਾਂਜੀ ਹਾਂਜੀ ਮੈਮ ਮੇਨ ਮੋਟਿਵ ਸਾਡਾ ਇਹੀ ਡਿਊਟੀ ਬਣਦੀ ਆ ਕਿ ਇਸਟਾਗਰਾਮ 'ਤੇ ਵੀਡੀਓ ਬਣਾਉਣੀ ਕੋਈ ਬੱਚਾ ਸਾਡੇ ਤੋਂ ਸਿੱਖ ਸਕੇ ਕੋਈ ਸਾਡਾ ਫੋਲੋਅਰ ਸਾਡੇ ਤੋਂ ਸਿੱਖ ਕੇ ਅੱਗੇ ਉਹਨੂੰ ਹੋਰ ਅਵੇਅਰਨੈਸ ਕ੍ਰੀਏਟ ਕਰ ਸਕੇ ਵਧਾ ਸਕੇ ਹਾਂਜੀ ਹਾਂਜੀ ਮੈ ਹੋਰ ਮੈਮ ਕਿਹੜੀ ਵੀਡੀਓ ਤੁਸੀਂ ਪਸੰਦ ਕਰਦੇ ਹੋ ਤੁਸੀਂ ਕੀ ਅੱਗੇ ਐਕਸਪੈਕਟ ਕਰਦੇ ਹੋ ਤੁਸੀਂ ਕਿਹੜੇ ਟੋਪਿਕ 'ਤੇ ਹੋਰ ਵੀਡੀਓ ਬਣਾਈ ਜਾਵੇ

ਹਾਂਜੀ ਹਾਂਜੀ ਬਿਲਕੁਲ ਮੈਮ ਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਮੈਮ ਬੋਇਜ ਵੀ ਉਨਾ ਹੀ ਸਟਰਗਲ ਕਰਦੇ ਆ ਜਿੰਨਾ ਕਿ ਇੱਕ ਗਰਲ ਕਰ ਰਹੀ ਆ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਅੱਜ ਕੱਲ ਸੋਸਾਇਟੀ ਦੇ ਵਿੱਚ ਮੇਨ ਇਹ ਹੈ ਕਿ ਟਾਈਪ ਚੱਲ ਰਿਹਾ ਕਿ ਰੂੜੀਵਾਦ ਦਾ ਲੋਕ ਇੱਕੋ ਹੀ ਸੋਚ ਦੇ ਨਾਲ ਚੱਲ ਰਿਹਾ ਕਿ ਬੋਏ ਦਾ ਐਕਸਪੀਰੀਅੰਸ ਗਰਲਸ ਨਾ ਸਾਰੇ ਇਹੀ ਸੋਚਦੇ ਆ ਸੇਮ ਥਿੰਕਿੰਗ ਰੱਖਦੇ ਅਤੇ ਪਰ ਆਪਾਂ ਟਰਾਈ ਕਰਨੀ ਆ ਕਿ ਇਸ ਸੋਚ ਨੂੰ ਬਦਲਿਆ ਜਾਵੇ

ਹਾਂਜੀ ਹਾਂਜੀ ਹਾਂਜੀ ਮੈਮ ਸਮਝ ਰਹੀ ਆ ਕਿ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਜਿਹੜੀਆਂ ਗਰਲਸ ਉਹੀ ਬ ਬੋਇਜ ਨੂੰ ਕਰ ਰਹੀ ਆ ਕਿ ਸ਼ੋਟ ਕੱਪੜੇ ਪਾ ਰਹੇ ਆ ਅਤੇ ਉਹਨਾਂ ਨੂੰ ਵੀਡੀਓ ਦੇ ਨਾਲ ਆਪਣੇ ਵੱਲ ਟਰੈਕਟਰ ਕਰਦੇ ਆ ਸਮਥਿੰਗ ਲਾਈਕ ਦੈਟ ਨਾ ਹਾਂਜੀ ਮੈਮ ਬਿਲਕੁਲ ਕਿਉਂਕਿ ਜੋ ਬਾਹਰ ਕੁਸ਼ ਚ ਆ ਗਿਆ ਬਾਹਰਲੀਆਂ ਕੰਟਰੀ 'ਚ ਚੱਲ ਰਿਹਾ ਉਹ ਸਾਰਾ ਹੀ ਆ ਰਿਹਾ ਤੁਸੀਂ ਸਾਰੇ ਜਨਰੇਸ਼ਨ ਹੀ ਬਾਹਰ ਜਾ ਰਹੀ ਸਾਡੀ ਹਾਂਜੀ ਹਾਂਜੀ ਮੈਮ ਜ਼ਰੂਰ ਟਰਾਈ ਕਰੂਗੀ ਕੋਈ ਮੈਨੂੰ ਕੋਈ ਸੁਜੈਸ਼ਨ ਦਿਓ ਕੋਈ ਟੋਪਿਕ ਦੋ ਕੋਈ ਮੈਂ ਉਤੇ ਬਣਾ ਸਕਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਮੈਮ ਮੈਂ ਇੱਕ ਸ਼ੂਟ ਦੇ ਲਈ ਜਾਣਾ ਆਪਾਂ ਫਿਰ ਗੱਲ ਕਰਦੇ ਆ ਤੁਸੀਂ ਮੇਰਾ ਨੰਬਰ ਸੇਵ ਕਰ ਲਓ ਐਨੀ ਟਾਈਮ ਯੂ ਕੈਨ ਸੋ ਓਕੇ ਜੀ ਥੈਂਕ ਯੂ ਜੀ